ਮੇਰਾ ਨਿੱਜੀ ਤੌਰ 'ਤੇ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਦੁਨੀਆ ਦੇ ਵਿੱਚ ਸਭ ਤੋਂ ਵੱਧ ਗਰੋਥ ਦੀ ਪੋਸੀਬਿਲੀਟੀ ਹੈਗੀ ਕਿਸੇ ਖੇਤਰ ਦੇ ਵਿੱਚ ਤਾਂ ਉਹ ਖੇਤੀਬਾੜੀ ਦੇ ਵਿੱਚ ਹੈਗੀ ਆ ਪਹਿਲਾ ਸੁਝਾਅ ਤਾਂ ਮੈਂ ਇਹ ਦਉਗਾ ਆਉਣ ਵਾਲੀ ਪੀੜੀ ਨੂੰ ਕਿ ਪੈਸੇ ਕਮਾਉਣ ਨੂੰ ਤਰਜੀਹ ਦੇਣ ਤੋਂ ਪਹਿਲਾਂ ਕਿ ਹਰ ਉਹ ਚੀਜ਼ ਜਿਹੜੀ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਖਾਂਦੇ ਹਾਂ ਉਹਦਾ ਮੈਂ ਇੱਥੇ ਜ਼ਿਕਰ ਨਹੀਂ ਕਰਨਾ ਲੰਬਾ ਹੋ ਜਾਵੇਗਾ ਉਹਦੇ ਵਿੱਚੋਂ ਪਚਾਨਵੇਂ ਫ਼ੀਸਦੀ ਚੀਜ਼ਾਂ ਜਿਹੜੀਆਂ ਸਾਡੇ ਖੇਤ ਦੇ ਵਿੱਚ ਉੱਗਦੀਆਂ ਨੇ ਪੈਦਾ ਹੁੰਦੀਆਂ ਨੇ ਅਸੀਂ ਪਹਿਲਾ ਉਨ੍ਹਾਂ ਨੂੰ ਉਗਾਉਣਾ ਤਰਜੀਹ ਦੇਣੀ ਹੈ ਔਰਗੈਨਿਕ ਸ਼ੁੱਧ ਰੂਪ ਦੇ ਵਿੱਚ ਬਿਨਾਂ ਰੇਹ ਸਪਰੇਅ ਪੈਸਟੀਸਾਈਡਸ ਨੂੰ ਵਰਤਣ ਤੋਂ ਬਿਨਾਂ ਔਰ ਦੂਸਰੀ ਗੱਲ ਮੈਂ ਇਹ ਸੁਝਾਅ ਦੇਣਾ ਚਾਹੁੰਦਾ ਆਉਣ ਵਾਲੀ ਪੀੜੀ ਨੂੰ ਕਿ ਅਸੀਂ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਨ੍ਹਾਂ ਦੀ ਕਾਸ਼ਤ ਕਰੀਏ ਜਿਨ੍ਹਾਂ ਨੂੰ ਪ੍ਰੋਸੈਸ ਕਰਕੇ ਸਟੋਰ ਕਰਕੇ ਬਜ਼ਾਰ ਦੇ ਵਿੱਚ ਵੇਚਿਆ ਜਾ ਸਕਦਾ ਜਿਹਦੇ ਵਿੱਚ ਸਰ੍ਹੋਂ ਦਾ ਤੇਲ ਕੱਢ ਕੇ ਵੇਚਿਆ ਜਾ ਸਕਦਾ ਹੈ ਗੰਨੇ ਨੂੰ ਜਿਹੜਾ ਹੈਗਾ ਉਹ ਛੋਟਾ ਮਿੱਲ ਪ੍ਰੋਡਕਟ ਲਾ ਪਲਾਂਟ ਲਾ ਕੇ ਵੇਚਿਆ ਜਾ ਸਕਦਾ ਹੈ ਕਣਕ ਨੂੰ ਚੱਕੀ ਲਾ ਕੇ ਪੀਹ ਕੇ ਮਾਰਕਾ ਰਜਿਸਟਰਡ ਕਰਾ ਕੇ ਵੇਚਿਆ ਜਾ ਸਕਦਾ ਹੈ ਇਸ ਕਰਕੇ ਆਉਣ ਵਾਲੀ ਪੀੜੀ ਨੂੰ ਮੈਂ ਇਹ ਸੁਝਾਅ ਦੇਣਾ ਚਾਹੁੰਦਾ ਕਿ ਉਹ ਆਪਣੀ ਜਿਹੜੀ ਖੇਤੀ ਉਨ੍ਹਾਂ ਉਹ ਪ੍ਰੋਡਕਟ ਜਿਹੜੇ ਹੈਗੇ ਨੇ ਉਹ ਉਤਪਾਦ ਬੀਜਣ ਜਿਨ੍ਹਾਂ ਨੂੰ ਪ੍ਰੋਸੈਸ ਕਰਕੇ ਸਟੋਰ ਕਰਕੇ ਮਾਰਕਿਟ ਦੇ ਵਿੱਚ ਆਪਣਾ ਮਾਰਕਾ ਰਜਿਸਟਰਡ ਕਰਾ ਕੇ ਵੇਚਿਆ ਜਾ ਸਕਦਾ ਹੈ ਥੈਂਕ ਯੂ